ਭਾਰਤੀ ਫਿਲਮਾਂ ਅਤੇ ਸੰਗੀਤ ਬਾਰੇ ਸੋਚਣਾ ਮਤਲਬ ਬਹੁਤ ਅੱਛਾ ਹੈ ਮਤਲਬ ਇਨਸਾਨ ਅਗਰ ਬੋਰ ਹੋ ਰਿਹਾ ਆਪਣਾ ਮਾਈਡ ਚੇਂਜ ਕਰਨਾ ਹੈ ਤਾਂ ਬਹੁਤ ਅੱਛਾ ਤਰੀਕਾ ਹੈ ਸੰਗੀਤ ਸੁਣਨਾ ਜਾਂ ਮੂ ਫਿਲਮਾਂ ਦੇਖਣਾ ਬਿਲਕੁਲ ਸਾਡਾ ਦਿਮਾਗ ਆ ਮੂਡ ਬਿਲਕੁਲ ਚੇਂਜ ਕਰ ਦਿੰਦੀਆਂ ਖਾਸ ਕਰ ਜੋ ਗਾਣੇ ਸੰਗੀਤ ਵਗੈਰਾ ਅਤੇ ਮੈਨੂੰ ਸਭ ਤੋਂ ਜ਼ਿਆਦਾ ਅੱਛੇ ਮਤਲਬ ਵਧੀਆ ਜੋ ਲੱਗਦੇ ਹੈ ਹਿੰਦੀ ਔਰ ਪੰਜਾਬੀ ਗਾਣੇ ਅੱਛੇ ਲੱਗਦੇ ਹੈ ਹਿੰਦੀ ਮਤਲਬ ਪੁਰਾਣੇ ਨਾਈਟੀਜ਼ ਵਾਲੇ ਅੱਛੇ ਲੱਗਦੇ ਹੈ ਜੋ ਨੱਬੇ ਦੇ ਦਸ਼ਕ ਵਾਲੇ ਸੀਗੇ ਉਹ ਵਾਲੇ ਗਾਣੇ ਪੰਜਾਬੀ ਪੰਜਾਬੀ ਮੈਨੂੰ ਸਾਰੇ ਤਰ੍ਹਾਂ ਦੇ ਗਾਣੇ ਅੱਛੇ ਲੱਗਦੇ ਹੈ ਔਰ ਸਭ ਤੋਂ ਅੱਛਾ ਜੋ ਹੈ ਮੇਰਾ ਫੇਵਰੇਟ ਹੀਰੋ ਆ ਅਭਿਨੇਤਾ ਜੋ ਹੈ ਉਹ ਮੈਨੂੰ ਤਰਸੇਮ ਜੱਸੜ ਲੱਗਦਾ ਉਹਦੀ ਐਕਟਿੰਗ ਬਹੁਤ ਅੱਛੀ ਹੈ ਔਰ ਅਭਿਨੇਤਰੀ ਜੋ ਹੈ ਉਹ ਸਿੰਮੀ ਚਹਿਲ ਜੋ ਹੈ ਮਤਲਬ ਉਹ ਬਿਲਕੁਲ ਇੱਦਾਂ ਲੱਗਦੀ ਆ ਕਿ ਮਤਲਬ ਐਕਟਿੰਗ ਨਹੀਂ ਲੱਗਦੀ ਉਹਨਾਂ ਦੀ ਮਤਲਬ ਵੀ ਐਕਟਿੰਗ ਕਰ ਰਹੇ ਮਤਲਬ ਇੱਦਾਂ ਲੱਗਦਾ ਨੈਚੁਰਲੀ ਜੋ ਇਨਸਾਨ ਜਿੱਦਾਂ ਉੱਦਾਂ ਹੀ ਬੋਲਦੇ ਉੱਦਾਂ ਹੀ ਅਭਿਨੈ ਕਰਦੇ ਹੈ ਔਰ ਹਿੰਦੀ ਸੌਂਗਸ ਜੋ ਪੁਰਾਣੇ ਨੇ ਉਹ ਮੈਨੂੰ ਬਹੁਤ ਅੱਛੇ ਲੱਗਦੇ ਹੈ ਔਰ ਸਭ ਤੋਂ ਫੇਵਰੇਟ ਜੋ ਮੇਰਾ ਹੈ ਗਜ਼ਲਕਾਰ ਜਗਜੀਤ ਸਿੰਘ ਉਹਨਾਂ ਦੀਆਂ ਗਜ਼ਲਾਂ ਮੈਨੂੰ ਬਹੁਤ ਅੱਛੀਆਂ ਲੱਗਦੀਆਂ ਮੈਂ ਬਹੁਤ ਸੁਣਦੀ ਹਾਂ ਮਤਲਬ ਮੇਰਾ ਜਿੱਦਾਂ ਦਾ ਵੀ ਮੂਡ ਹੋਏ ਉਹ ਬਿਲਕੁਲ ਚੇਂਜ ਹੋ ਜਾਂਦਾ ਉਹਨਾਂ ਦੀਆਂ ਗਜ਼ਲ ਸੁਣ ਕੇ ਅਗਰ ਮੈਂ ਖੁਸ਼ ਹਾਂ ਸ ਮਤਲਬ ਬਹੁਤ ਉਦਾਸ ਹਾਂ ਮਤਲਬ ਉਹਨਾਂ ਦੀਆਂ ਗਜ਼ਲਜ਼ ਮੇਰਾ ਮੂਡ ਚੇਂਜ ਕਰ ਦਿੰਦੀਆਂ ਬਿਲਕੁਲ ਇਕਦਮ ਤਰੋ ਤਾਜ਼ਾ ਕਰ ਦਿੰਦੀਆਂ ਮੈਨੂੰ